ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਬਕ ਸਿੱਖੇ ਹਨ ਮੈਂ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਵੱਡਿਆਂ ਦਾ ਮਾਣ ਆਦਰ ਅਤੇ ਛੋਟਿਆਂ ਨੂੰ ਪਿਆਰ ਕੀਤਾ ਹੈ ਜ਼ਿੰਦਗੀ ਵਿੱਚ ਕਿਸੇ 'ਤੇ ਅੱਖਾਂ ਮੀਚ ਕੇ ਭਰੋਸਾ ਨਹੀਂ ਕਰਨਾ ਚਾਹੀਦਾ ਹੈ ਅੱ ਅੱਜ ਕੱਲ੍ਹ ਦੇ ਟਾਈਮ ਵਿੱਚ ਕਿਸੇ ਨੂੰ ਉਧਾਰ ਨਹੀਂ ਦੇਣਾ ਚਾਹੀਦਾ ਹੈ ਉਧਾਰ ਦੇਣ ਤੋਂ ਪਹਿਲਾਂ ਸੌ ਵਾਰ ਸੌਚਣਾ ਚਾਹੀਦਾ ਹੈ ਉਧਾਰ ਉਸ ਬੰਦੇ ਨੂੰ ਦਿਓ ਜਿਸ 'ਤੇ ਆਪਣੇ ਆਪ ਨੂੰ ਪੂਰਾ ਭਰੋਸਾ ਹੋਵੇ ਕਿ ਵਾਪਸ ਵੀ ਕਰ ਦੇਵੇਗਾ ਇਸ ਤਰ੍ਹਾਂ ਜ਼ਿੰਦਗੀ ਵਿੱਚ ਸਿੱਖਣ ਨੂੰ ਬਹੁਤ ਕੁਛ ਮਿਲਦਾ ਹੈ